ਪੰਜਾਬ ਦਾ ਵਿਰਸਾ ਬਹੁਤ ਅਮੀਰ ਵਿਰਸਾ ਹੈ ਇਸ ਨੇ ਬਹੁਤ ਸਾਰੀਆਂ ਕਲਾਵਾਂ ਨੂੰ ਜਨਮ ਦਿੱਤਾ ਹੈ ਜਿਵੇਂ ਫੁਲਕਾਰੀਆਂ ਬਾਗ ਮਿੱਟੀ ਦੇ ਬਰਤਨ ਤਾਂਬੇ ਦੇ ਬਰਤਨ ਚਿੱਤਰਕਾਰੀ ਦੀਵਾਰਾਂ 'ਤੇ ਚਿੱਤਰਕਾਰੀ ਕਢਾਈਆਂ ਪੱਖੀਆਂ ਬਣਾਉਣੀਆਂ ਘੜੇ ਚੱਕਰੀਆਂ ਆਦਿ ਬਣਾਉਣੀਆਂ ਘੁੰਮਿਆਰਾਂ ਜਲਾਹੇ ਆਦਿ ਦਾ ਕੰਮ ਇਹ ਕਾਰ ਕੀਤੀਆਂ ਹੀ ਹਨ ਗੈਲਰੀਆਂ ਜਾਂ ਹਵੇਲੀਆਂ ਵਿੱਚ ਹੋਟਲਾਂ ਵਿੱਚ ਇਹਨਾਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਅਤੇ ਇਹਨਾਂ ਨੂੰ ਵਧੀਆ ਮੁੱਲ 'ਤੇ ਵੇਚਿਆ ਖਰੀਦਿਆ ਜਾਂਦਾ ਹੈ ਜਦੋਂ ਜਦੋਂ ਕਿਤੇ ਮੇਲੇ ਲੱਗਦੇ ਹਨ ਤਾਂ ਉੱਥੇ ਵੀ ਇਹਨਾਂ ਦੀ ਵਿਕਰੀ ਕੀਤੀ ਜਾਂਦੀ ਹੈ ਔਨਲਾਈਨ ਵੀ ਇਹਨਾਂ ਦੀ ਖਰੀਦਦਾਰੀ ਕਾਫੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ